ਹੈਲੋ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਪੰਜਾਬ ਬੁੱਕ ਸੈਂਟਰ ਤੋਂ ਬੋਲਦੇ ਆ ਜੀ ਮੈਮ ਅਸੀਂ ਕਾਲਜ ਤੋਂ ਬੋਲ ਰਹੇ ਹਾਂ ਜੀ ਬਰਨਾਲਾ ਕਾਲਜ ਤੋਂ ਐਸ ਡੀ ਕਾਲਜ ਬਰਨਾਲਾ ਜੀ ਸਾਨੂੰ ਬੁੱਕਸ ਚਾਹੀਦੀਆਂ ਸੀ ਜੀ ਆਪਣੇ ਬੱਚਿਆਂ ਵਾਸਤੇ ਸਾਨੂੰ ਵਰਿਆਮ ਮਸਤ ਅਤੇ ਵਰਿਆਮ ਸੰਧੂ ਦੀਆਂ ਚਾਹੀਦੀਆਂ ਹੈ ਜੀ ਹਾਂਜੀ ਅਤੇ ਸਾਨੂੰ ਪ੍ਰਾਈਜ਼ ਦੱਸ ਦਿਓ ਜੀ ਮਾੜਾ ਜਿਹਾ ਕਿੰਨਾ ਕਿੰਨਾ ਲੱਗੇਗਾ ਠੀਕ ਹੈ ਜੀ ਠੀਕ ਆ ਜੀ ਅਤੇ ਤੁਸੀਂ ਨੋਰਮਲ ਕਿੰਨੇ ਪਰਸੈਂਟ ਤੱਕ ਡਿਸਕਾਊਂਟ ਕਰਦੇ ਹੋ ਜੀ ਠੀਕ ਹੈ ਜੀ ਠੀਕ ਹੈ ਜੀ ਸਾਨੂੰ ਚਾਹੀਦੀਆਂ ਤਾਂ ਵੈਸੇ ਇਕੱਠੀਆਂ ਹੀ ਹੈ ਜੀ ਪਰ ਸਾਨੂੰ ਠੀਕ ਹੈ ਜੀ ਸਾਨੂੰ ਅਲੱਗ ਅਲੱਗ ਕਲਾਸਿਜ਼ ਦੀਆਂ ਚਾਹੀਦੀਆਂ ਬੀ ਏ ਐਮ ਏ ਦੀਆਂ ਜੀ ਤੁਸੀਂ ਨੋਟ ਕਰ ਲਓ ਜੀ ਇੱਕ ਵਾਰ ਇੱਕ ਤਾਂ ਵਰਿਆਮ ਮਸਤ ਦੀਆਂ ਲਿਖ ਲਓ ਜੀ ਵਰਿਆ ਮਸਤ ਦੀਆਂ ਲਿਖ ਲਓ ਜੀ ਬਸ ਕਲਾਸ ਦਾ ਤਾਂ ਕੋਈ ਹਾਂਜੀ ਟਵੀਟੀ ਬੁੱਕਸ ਲਿਖ ਲਓ ਟਵੀਟੀ ਟੈਲਸੀ ਇੱਕ ਨਾਟਕ ਬਾਕੀ ਹੈ ਹਾਂਜੀ ਇਹਨਾਂ ਦੇ ਪੰਜਾਹ ਪੰਜਾਹ ਕਰ ਦਿਓ ਜੀ ਤਿੰਨਾਂ ਦੇ ਹਾਂਜੀ ਇਹ ਚਾਹੀਦੀ ਹੈ ਛੱਬੀ ਅਗਸਤ ਤੱਕ ਕੋਲਜ 'ਚ ਪਹੁੰਚਾ ਦਿਓ ਜੀ ਤੁਸੀਂ ਹਾਂਜੀ ਕੋਈ ਗੱਲ ਨਹੀਂ ਜੀ ਅਸੀਂ ਕਰ ਦਾਂਗੇ ਤੁਸੀਂ ਸਾਨੂੰ ਦੱਸ ਦਿਓ ਵੀ ਕਿੰਨਾ ਕੁ ਖਰਚਾ ਆਊਗਾ ਸਾਡਾ ਅਤੇ ਹਾਂਜੀ ਬਾਕੀ ਤੁਸੀਂ ਬਾਕੀ ਬੁੱਕਸ ਵੀ ਲਿਖ ਹੀ ਲਓ ਵਰਿਆਮ ਸੰਧੂ ਦੀਆਂ ਲਿਖ ਲਓ ਜੀ ਚੌਥੀ ਕੂਟ ਲਿਖ ਲਓ ਜੀ ਇਹਦੀਆਂ ਵੀ ਸਾਨੂੰ ਪੰਜਾਹ ਪੀਸ ਚਾਹੀਦੇ ਹੈ ਜੀ ਹਾਂਜੀ ਅਤੇ ਕੁਛ ਤੁਸੀਂ ਕੁਛ ਕੁ ਰਾਈਟਰਾਂ ਦੀਆਂ ਵਿੱਚ ਸਵੈ ਜੀਵਨੀਆਂ ਭੇਜ ਦਿਓ ਜੀ

ਨਹੀਂ ਅਸੀਂ ਲਾਈਬ੍ਰੇਰੀ ਵੀ ਵੈਸੇ ਖੋਲ੍ਹਣੀ ਆ ਜੀ ਬਾਕੀ ਅਸੀਂ ਇੱਕ ਵਾਰ ਬੁਕਸ ਦਾ ਅਰੇਂਜਮੈਂਟ ਕਰ ਰਹੇ ਹਾਂ ਕਿਸੇ ਹੋਰ ਪਾਸੋਂ ਅਸੀਂ ਔਡਰ ਦਿੱਤਾ ਹੋਇਆ ਜੇ ਸਾਡਾ ਉਧਰੋਂ ਨਾ ਬਣਿਆ ਫਿਰ ਅਸੀਂ ਤੁਹਾਡੇ ਤੋਂ ਹੋਰ ਮੰਗਵਾ ਲਾਂਗੇ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਮੈਮ ਓਕੇ ਜੀ ਧੰਨਵਾਦ